ਸਰ ਜੀ ਵਾਤਾਵਰਨ ਵਿੱਚ ਕਾਫੀ ਹੀਟ ਵੱਧ ਰਹੀ ਹੈ ਕੀ ਇਸਦਾ ਕਾਰਨ ਐਨਰਜੀ ਸਰੋਤ ਵੀ ਹਨ ਜਿਨਾਂ ਨਾਲ ਵਾਤਾਵਰਨ ਤੇ ਪ੍ਰਭਾਵ ਪੈ ਰਿਹਾ ਹੈ ਮੇਰੇ ਖਿਆਲ ਨਾਲ ਬਿਜਲੀ ਦੀ ਮੰਗ ਵਧਣ ਨਾਲ ਵੀ ਦਰਖਤ ਕੱਟੇ ਜਾ ਰਹੇ ਹਨ ਅਤੇ ਖੰਬੇ ਲਗਾਏ ਜਾ ਰਹੇ ਹਨ ਅਤੇ ਐਨਰਜੀ ਖਤ ਦਾ ਵਾਤਾਵਰਨ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅੱਜ ਕੱਲ ਘਰ ਬਿਜਲੀ ਦੀ ਖਪਤ ਬਹੁਤ ਜਿਆਦਾ ਵੱਧ ਗਈ ਹੈ ਘਰ ਘਰ ਕੰਪਿਊਟਰ ਲੱਗੇ ਹੋਏ ਹਨ ਘਰ ਘਰ ਵਿੱਚ ਏਸੀ ਲੱਗਿਆ ਹੋਇਆ ਹੈ ਇਕ ਸਰ ਜੀ ਇਸ ਦਾ ਸੋਲਰ ਪੈਨਲ ਲਗਾ ਕੇ ਕੋਈ ਹੱਲ ਹੋ ਸਕਦਾ ਹੈ ਸਰ ਆਪਣਾ ਮਕਾਨ ਪਿੰਡ ਦੇ ਵਿਚਕਾਰ ਹੈ ਕੀ ਆਪਣਾ ਘਰ ਆਪਣਾ ਲੋੜ ਦੋ ਸੌ ਪੰਜਾਹ ਕਿਲੋਵਾਟ ਹੈ ਜੀ ਇਸ ਕਰਕੇ ਇਹ ਦੱਸਿਓ ਕਿ ਸੋਲਰ ਦੇ ਕਿੰਨੇ ਪੈਨਲ ਲੱਗਣਗੇ ਅਤੇ ਇਸਦੀ ਕਿੰਨੀ ਲਾਗਤ ਆ ਸਕਦੀ ਹੈ ਜੀ ਇਸਦੀ ਸੰਭਾਵਨਾ ਬਾਰੇ ਜਰੂਰੀ ਦੱਸਣਾ ਜੀ ਤਾਂ ਕਿ ਵਾਤਾਵਰਨ ਦੀ ਸੰਭਾਲ ਵਿੱਚ ਵੀ ਯੋਗਦਾਨ ਪੈ ਜਾਵੇ ਅਤੇ ਐਨਰਜੀ ਦੀ ਬੱਚਤ ਵੀ ਹੋ ਸਕੇ ਪੈਨਲ ਬਾਰੇ ਜਰੂਰ ਦੱਸਣਾ ਸਰ ਜੀ ਧੰਨਵਾਦ